ਮੈਨੂੰ ਸੰਗੀਤ ਅਤੇ ਸਾਜ਼ ਹਾਰਮੋਨੀਅਮ ਬਾਰੇ ਥੋ ਜਾਣਕਾਰੀ ਹੈ ਕਿਉਂਕਿ ਮੇਰੇ ਪਿਤਾ ਜੀ ਨੇ ਮੈਨੂੰ ਹਾਰਮੋਨੀਅਮ ਲੈ ਕੇ ਦਿੱਤਾ ਸੀ ਅਤੇ ਉਹ ਮੈਨੂੰ ਥੋੜ੍ਹਾ ਬਹੁਤ ਬਚਪਨ ਤੋਂ ਹੀ ਵਜਾਉਣਾ ਆਉਂਦਾ ਸੀ ਅਤੇ ਥੋੜ੍ਹਾ ਬਹੁਤਾ ਮੈਂ ਹੁਣ ਹੀ ਵਜਾ ਲੈਂਦਾ ਹਾਂ ਅਤੇ ਮੈਨੂੰ ਹਾਰਮੋਨੀਅਮ ਦੇ ਵਿੱਚ ਕਈ ਸਰਗਮਾਂ ਅਤੇ ਕਈ ਸਾਰੇ ਰਾਗ ਵਗੈਰਾ ਵੀ ਆਉਂਦੇ ਹਨ ਅਤੇ ਕਈ ਸ਼ਬਦ ਵੀ ਵਜਾ ਲੈਂਦਾ ਹਾਂ ਅਤੇ ਗਾ ਵੀ ਲੈਂਦਾ ਹਾਂ